ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਜੀ ਜੀ ਜੀ ਮਸਲਾ ਇਹ ਹੈ ਜੀ ਕਿ ਜਿਹੜਾ ਤੁਹਾਡਾ ਮਕਾਨ ਦਾ ਕੇਸ ਹੈ ਇਹ ਸਮਝ ਲਓ ਕਿ ਪਟੀਸ਼ਨ ਹੈ ਜਿਹੜੀ ਆਪਾਂ ਅਦਾਲਤ ਤੱਕ ਤਾਂ ਲੈ ਗਏ ਹਾਂ ਉੱਥੇ ਤੱਕ ਜਿਹੜੇ ਤੁਹਾਡਾ ਵਿਰੋਧੀ ਧਿਰ ਹੈ ਉਹ ਵੀ ਆਪਾਂ ਖਿੱਚ ਕੇ ਲੈ ਆਏ ਹਾਂ ਅਤੇ ਹੁਣ ਇਹ ਹੈ ਕਿ ਮਸਲਾ ਅਦਾਲਤ ਦੇ ਉੱਤੇ ਹੀ ਖੜ੍ਹਾ ਵੀ ਉਹ ਆਪਣੇ ਕੇਸ ਦਾ ਫੈਸਲਾ ਕਦੋਂ ਕੁ ਸੁਣਾਉਂਦੇ ਨੇ ਉਮੀਦ ਹੈ ਕਿ ਆਉਣ ਵਾਲੀਆਂ ਇੱਕ ਜਾਂ ਦੋ ਤਰੀਕਾਂ ਦੇ ਵਿੱਚ ਉਹ ਆਪਣਾ ਜਿਹੜਾ ਕੇਸ ਹੈ ਉਹ ਨਿਬੜ ਸਕਦਾ ਤਰੀਕਾਂ ਉਮੀਦ ਤਾਂ ਇਹੀ ਆ ਭਰਾ ਜੀ ਕਿ ਦੋ ਜਾਂ ਤਿੰਨ ਦੇ ਵਿੱਚ ਇਹ ਨਿੱਬੜ ਸਕਦਾ ਤੁਹਾਡਾ ਕੇਸ ਬਾਕੀ ਅਦਾਲਤ 'ਤੇ ਡਿਪੈਂਡ ਹੈ ਜੇ ਉਹ ਆਪਣੇ ਸਬੂਤ ਨੇ ਜਿਹੜੇ ਉਹਨਾਂ ਦੇ ਅਧਾਰ 'ਤੇ ਉਹਨਾਂ ਨੂੰ ਠੀਕ ਮੰਨਦੀ ਹੈ ਫਿਰ ਤਾਂ ਫੈਸਲਾ ਜਲਦੀ ਆ ਸਕਦਾ ਜੇ ਉਹਨੇ ਕੁਝ ਹੋਰ ਕਹਿ ਦਿੱਤਾ ਜਾਂ ਹੋਰ ਕੋਈ ਕਾਰਵਾਈ ਜਾਂ ਹੋਰ ਕਾਗਜ਼ ਮੰਗਦੀ ਹੈ ਫਿਰ ਤਰੀਕਾਂ ਵੱਧ ਵੀ ਸਕਦੀਆਂ ਨੇ ਫਿਰ ਆਪਾਂ ਨੂੰ ਆਪ ਵੀ ਸਮਾਂ ਲੈਣਾ ਪੈ ਸਕਦਾ ਹਾਂਜੀ ਹਾਂ ਜੇ ਫੈਸਲਾ ਆਪਣੇ ਹੱਕ 'ਚ ਹੁੰਦਾ ਜਿਹਦੀ ਕਿ ਬਹੁਤੀ ਆਪਾਂ ਨੂੰ ਉਮੀਦ ਹੈ ਕਿ ਹੋਏਗਾ ਹੀ ਅਤੇ ਫਿਰ ਸਰਕਾਰ ਤੁਹਾਡੇ ਨਾਲ ਬਕਾਇਦਾ ਪੁਲਿਸ ਵਾਲੇ ਭੇਜ ਕੇ ਬਕਾਇਦਾ ਤੁਹਾਡਾ ਏ ਹਵਾਲੇ ਕਰਕੇ ਕੂੰਜੀਆਂ ਅਤੇ ਤੁਹਾਡਾ ਕਬਜ਼ਾ ਵੀ ਕਰਵਾਏ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੋਏਗਾ ਕਿ ਦੇਖ ਲਓ ਜੀ ਆਪਣੀ ਜਿਵੇਂ ਸ਼ੁਰੂ ਦੇ ਵਿੱਚ ਹੀ ਗੱਲ ਹੋਈ ਸੀਗੀ ਅਤੇ ਆਪਣਾ ਸਾਰੇ ਕੇਸ ਡੇਢ ਕੁ ਲੱਖ ਦੇ ਵਿੱਚ ਨਿਬੜ ਜਾਏਗਾ ਕੁਝ ਇਹਦੇ ਵਿੱਚ ਸਰਕਾਰੀ ਫੀਸਾਂ ਵੀ ਨੇ ਅਤੇ ਉਹਦੇ ਵਿੱਚੋਂ ਕੁਛ ਕੁ ਅੱਧ ਕੁ ਹਿੱਸਾ ਏ ਜਿਹੜਾ ਉਹ ਸਾਡਾ ਏ ਚਲੋ ਆਪਾਂ ਆਪਣੇ ਵਾਲਾ ਹਿੱਸਾ ਜਿਹੜਾ ਉਹ ਟਾਈਮ 'ਤੇ ਦੇਖ ਲਾਂਗੇ ਲੈਸ ਵੀ ਕਰ ਦਾਂਗੇ ਕਿਉਂ ਕਰਕੇ ਤੁਸੀਂ ਸਾਡੇ ਆਪਣੇ ਰਿਸ਼ਤੇਦਾਰਾਂ ਦੇ ਕਹਿਣ 'ਤੇ ਹੀ ਆਏ ਸੀ ਆਪਣੇ ਕੋਲ ਕੇਸ ਲੈ ਕੇ ਹਾਂ ਹਾਂ ਕੋਈ ਗੱਲ ਨਹੀਂ ਉਹ ਕਰ ਲਾਂਗੇ ਆਪਾਂ ਮੌਕੇ 'ਤੇ ਠੀਕ ਹੈ ਠੀਕ ਹੈ ਭਰਾ